ਮੈਂ ਆਪਣੇ ਬਗੀਚੇ ਵਿੱਚ ਪੌਦੇ ਲਗਾਉਣ ਲਈ ਨੇੜੇ ਦੀ ਨਰਸਰੀ ਤੋਂ ਲੈ ਕੇ ਆਉਂਦਾ ਹਾਂ ਪਰੰਤੂ ਮੇਰੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੈਂ ਆਪਣੇ ਪੌਦੇ ਆਪਣੇ ਹੱਥ ਨਾਲ ਤਿਆਰ ਕਰ ਸਕਾਂ ਇਸ ਲਈ ਮੈਂ ਦੇਸੀ ਖਾਦ ਦੀ ਵਰਤੋਂ ਕਰਦਾ ਹਾਂ ਅਤੇ ਅੰਬ ਦੀ ਗਿਟਕਾਂ ਅਤੇ ਜਾਮੁਨ ਦੀਆਂ ਗਿਟਕਾਂ ਆਦਿ ਨੂੰ ਦੇਸੀ ਖਾਦ ਨਾਲ ਭਰੇ ਹੋਏ ਟੋਏ ਵਿੱਚ ਪਾ ਕੇ ਦਬਾ ਦਿੰਦਾ ਹਾਂ ਅਤੇ ਪੁੰਗਰਣ ਵੇਲੇ ਬੂਟਿਆਂ ਵਿੱਚ ਵਿੱਚੋਂ ਸਿਹਤਮੰਦ ਬੂਟਿਆਂ ਦੀ ਛਾਂਟੀ ਕਰ ਲੈਂਦਾ ਹਾਂ ਮੇਰੇ ਵੱਲੋਂ ਨਿੰਬੂ ਜਾਤੀ ਦੇ ਬੂਟੇ ਇਹਨਾਂ ਦੀ ਖਾ ਦਾਖ ਤੋਂ ਵੀ ਤਿਆਰ ਕੀਤੇ ਗਏ ਹਨ ਗੁਲਾਬ ਦੀਆਂ ਦਾਖਾਂ ਤੋਂ ਮੇਰੇ ਵੱਲੋਂ ਖੁਦ ਤਿਆਰ ਪਰ ਕੀਤੇ ਬੂਟੇ ਵੀ ਮੇਰੇ ਬਗੀਚੇ ਦੀ ਸ਼ਾਨ ਨੂੰ ਵਧਾ ਰਹੇ ਹਨ ਮੈਂ ਆਪਣੇ ਬਗੀਚੇ ਦੀ ਸ਼ਾਨ ਵਧਾਉਣ ਲਈ ਬਾਗਬਾਨੀ ਵਿਭਾਗ ਨਾਲ ਵੀ ਰਾਬਤਾ ਰੱਖਦਾ ਹਾਂ ਅਤੇ ਕਿਸਾਨ ਮੇਲਿਆਂ ਵਿੱਚ ਸ਼ਾਮਿਲ ਹੋ ਕੇ ਉਥੋਂ ਵੀ ਕਈ ਨਵੀਆਂ ਕਿਸਮਾਂ ਦੇ ਪੌਦੇ ਪ੍ਰਾਪਤ ਕਰਦਾ ਹਾਂ ਇਹਨਾਂ ਵਿੱਚੋਂ ਜਿਵੇਂ ਕਿ ਫ਼ਲਾਂ ਦੇ ਪੌਦੇ ਅਤੇ ਛਾਵਾਂ ਵਾਲੇ ਪੌਦੇ ਅਤੇ ਕਈ ਤਰ੍ਹਾਂ ਦੇ ਫੁੱਲਾਂ ਦੀਆਂ ਵੀ ਵੀ ਫੁੱਲਾਂ ਦੀਆਂ ਵੀ ਪਨੀਰੀਆਂ ਲੈ ਕੇ ਆਉਂਦਾ ਆਉਂਦਾ ਹਾਂ